ਜਦੋਂ ਅਸੀਂ ਇੱਕ ਪੈਨਸਿਲ ਨਾਲ ਚਿੱਤਰ ਬਣਾਉਂਦੇ ਹਾਂ ਉਦੋਂ ਉਸਨੂੰ ਬਣਾਉਣਾ ਬਹੁਤ ਸੌਖਾ ਹੁੰਦਾ ਹੈ ਕਿਉਂਕਿ ਪੈਨਸਿਲ ਨਾਲ ਬਣਾਈ ਚੀਜ਼ ਹਮੇਸ਼ਾਂ ਮਿਟਾਈ ਜਾ ਸਕਦੀ ਹੈ ਸਹੀ ਕੀਤੀ ਜਾ ਸਕਦੀ ਹੈ ਅਤੇ ਅਸੀਂ ਉਹਨੂੰ ਦੁਬਾਰਾ ਬਣਾ ਕੇ ਵੀ ਵਧੀਆ ਕਰ ਸਕਦੇ ਹਾਂ ਬੱਟ ਜਦੋਂ ਅਸੀਂ ਪੱਕੇ ਤੌਰ 'ਤੇ ਪੈੱਨ ਨਾਲ ਸਕੈਚ ਪੈੱਨ ਨਾਲ ਜਾਂ ਪੇਂਟਾਂ ਨਾਲ ਪੇਂਟਿੰਗ ਬਣਾਉਣ ਜਾਣਦੇ ਹਾਂ ਉਦੋਂ ਜਿਹੜਾ ਹੈ ਉਹ ਸਾਡੇ ਤੋਂ ਕਈ ਵਾਰ ਐਸੀ ਗਲਤੀਆਂ ਹੋ ਜਾਂਦੀਆਂ ਹਨ ਜਿਹੜੀਆਂ ਮਟੇਣੀਆਂ ਔਖੀਆਂ ਹਨ ਦੁਬਾਰਾ ਬਣਾਉਣੀਆਂ ਔਖੀਆਂ ਹਨ ਅਤੇ ਇੱਦਾਂ ਦੀਆਂ ਗਲਤੀਆਂ ਸਾਡੇ ਪੂਰੇ ਚਿੱਤਰ ਨੂੰ ਖ਼ਰਾਬ ਕਰ ਦਿੰਦੀਆਂ ਹਨ ਅਤੇ ਇਹ ਚਿੱਤਰਕਾਰੀ ਦਾ ਸਭ ਤੋਂ ਔਖਾ ਪਹਿਲੂ ਹੁੰਦਾ ਹੈ ਜਿਹਨੂੰ ਠੀਕ ਕਰਨ ਲਈ ਸਾਨੂੰ ਅਭਿਆਸ ਕਰਨ ਦੀ ਲੋੜ ਹੁੰਦੀ ਹੈ ਸਾਨੂੰ ਇੱਕ ਪੱਕੀ ਕੋਪੀ ਲਗਾ ਲੈਣੀ ਚਾਹੀਦੀ ਹੈ ਅਤੇ ਉਸ 'ਚ ਰੋਜ਼ ਅਭਿਆਸ ਕਰਨਾ ਚਾਹੀਦਾ ਹੈ ਜੋ ਅਸੀਂ ਸਿੱਖਣਾ ਚਾਹੁੰਦੇ ਹਾਂ ਜੋ ਅਸੀਂ ਬਣਾਉਣਾ ਚਾਹੁੰਦੇ ਹਾਂ ਉਸਨੂੰ ਰੋਜ਼ ਅਭਿਆਸ ਕਰਕੇ ਉਹਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਹਦੇ ਵਿੱਚ ਵਧੀਆ ਹੋ ਜਾਈਏ ਜਿਹੜੀਆਂ ਸਭ ਤੋਂ ਔਖੀਆਂ ਚੀਜ਼ਾਂ ਨੇ ਬਣਾਉਣ ਲਈ ਉਹ ਹੈਗੀਆਂ ਨੇ ਕਿਸੇ ਅਸਲ ਜ਼ਿੰਦਗੀ ਦਾ ਪੋਰਟਰੇਟ ਜਿਵੇਂ ਕਿ ਕਹਿ ਲਓ ਕੋਈ ਕੁਰਸੀ ਪਈ ਹੈ ਕੋਈ ਸੇਬ ਪਿਆ ਹੈ ਕਿਸੇ ਬੰਦੇ ਦੀ ਸ਼ਕਲ ਹੈ ਅਸਲੀ ਚੀਜ਼ ਨੂੰ ਬਣਾਉਣ ਲਈ ਬਹੁਤ ਮਿਹਨਤ ਲੱਗਦੀ ਹੈ ਬਹੁਤ ਅਭਿਆਸ ਲੱਗਦੀ ਹੈ ਮੈਂ ਅਭਿਆਸ ਕਰਨ ਲਈ ਇੱਕ ਅਲੱਗ ਪੱਕੀ ਕੋਪੀ ਲਗਾ ਰੱਖੀ ਹੈ ਜਿਹਦੇ ਉੱਤੇ ਰੋਜ਼ ਮੈਂ ਕੋਈ ਨਾ ਕੋਈ ਚੀਜ਼ ਬਣਾ ਕੇ ਅਭਿਆਸ ਕਰਦੀ ਹਾਂ ਕਿ ਮੇਰੀ ਡਰਾਇੰਗ ਜਿਹੜੀ ਪੇਂਟਿੰਗ ਹੈ ਚਿੱਤਰਕਾਰੀ ਹੈ ਉਹ ਵਧੀਆ ਹੋਵੇ ਅਤੇ ਮੈਂ ਹੋਰ ਵਧੀਆ ਵਧੀਆ ਚੀਜ਼ਾਂ ਬਣਾ ਸਕਾਂ